ਪੰਜਾਬ ਦੇ ਜੋ ਆਵਾਜਾਈ ਦੇ ਵਿੱਚ ਜੋ ਭੂਗੋਲ ਹੈ ਇੱਥੋਂ ਦਾ ਜਿਹੜੀ ਜੌਗਰਾਫ਼ੀ ਹੈ ਉਹਦਾ ਕਾਫ਼ੀ ਵੱਡਾ ਜਿਹੜਾ ਹੈ ਇੰਪੋਰਟੈਂਟ ਰੋਲ ਆ ਪੰਜਾਬ ਦੀ ਜਿਹੜੀ ਹੈਗੀ ਆ ਜੌਗਰਾਫ਼ੀ ਇੱਕ ਤਾਂ ਪਲੇਨ ਏਰੀਆ ਹੈ ਮੈਦਾਨੀ ਇਲਾਕਾ ਇੱਥੇ ਜਿਹੜੀ ਹੈਗੀ ਆਵਾਜਾਈ ਦੇ ਸਾਧਨ ਵਧੀਆ ਡਿਵੈਲਪ ਹੋਏ ਵੇ ਨੇ ਟਰਾਂਸਪੋਰਟੇਸ਼ਨ ਸਿਸਟਮ ਕਾਫ਼ੀ ਜ਼ਿਆਦਾ ਵਧੀਆ ਨੈੱਟਵਰਕ ਡਿਵੈਲਪ ਹੋਇਆ ਵਾ ਹੈਗਾ ਰੋਡਸ ਆਪਸ 'ਚ ਕਾਫ਼ੀ ਕਨੈੱਕਟਿਡ ਨੇ ਸਿੱਧੀਆਂ ਜਿਹੜੀ ਹੈਗੀ ਆ ਫਾਜ਼ਿਲਕਾ ਤੋਂ ਲੈ ਕੇ ਸਿੱਧਾ ਚੰਡੀਗੜ੍ਹ ਤੱਕ ਦੇ ਅੱਗੇ ਜਿਹੜੀ ਹੈਗਾ ਦਿੱਲੀ ਤੱਕ ਦੀ ਐਨ ਐੱਸ ਸੈਵਨ ਡਿਵੈਲਪ ਹੋਈ ਵੀ ਆ ਡਬਲ ਲੇਨ ਹੈਗੀ ਆ ਅਤੇ ਕਾਫ਼ੀ ਬਰੋਡ ਹੈਗੀਆਂ ਰੋਡਜ਼ ਨੇ ਸਿੱਧੀ ਅੰਬਰਸਰ ਤੋਂ ਲੈ ਕੇ ਦਿੱਲੀ ਤੱਕ ਕੁਨੈਕਸ਼ਨ ਹੈ ਬਾਕੀ ਜਿਹੜਾ ਨੈੱਟਵਰਕਸ ਨੇ ਸਟੇਟ ਡਿਸਟ੍ਰਿਕਟ ਡ ਜਿਹੜੇ ਹੈਡਕੁਆਰਟਰਸ ਨੇ ਅੱਗੇ ਜਿਹੜੇ ਵਿਲੇਜਸ ਨੇ ਪਿੰਡ ਨੇ ਉਹਨਾਂ ਦਾ ਆਪਸ ਕਨੈਕਟ ਬੜਾ ਹੀ ਵੈੱਲ ਡਿਵੈਲਪਡ ਹੈ ਇਹਦਾ ਮੇਨ ਕਾਰਨ ਇੱਥੋਂ ਦੀ ਜੌਗਰਾਫ਼ੀ ਹੈ ਕਿਉਂਕਿ ਇੱਥੋਂ ਜਿਹੜਾ ਪਲੇਨ ਏਰੀਆ ਹੋਣ ਕਰਕੇ ਪਦ ਮੈਦਾਨੀ ਇਲਾਕਾ ਹੋਣ ਕਰਕੇ ਇੱਥੇ ਵਧੀਆ ਤਰੀਕੇ ਨਾਲ਼ ਸਾਰੀ ਇਹ ਡਿਵੈਲਪਮੈਂਟ ਹੋ ਸਕੀ ਆ ਰੀਵਰ ਜਿਹੜੀ ਹੈਗੀਆਂ ਨੇ ਉਹ ਵੀ ਇੱਥੇ ਵੈੱਲ ਕਨੈੱਕਟਿਡ ਨੇ ਉਹਦੇ ਨਾਲ਼ ਵੀ ਜਿਹੜੀ ਹੈਗੀ ਟਰਾਂਸਪੋਰਟੇਸ਼ਨ ਸਿਸਟਮ ਜਿਹੜੇ ਹੈ ਜਾਂ ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਹੈ ਬੌਰਡਰ ਸਟੇਟ ਹੈ ਨ ਪਾਕਿਸਤਾਨ ਇੰਟਰਨੈਸ਼ਨਲ ਬੌਰਡਰ ਲੱਗ ਰਿਹਾ ਹੈਗਾ ਜਿਹੜੀ ਇੰਡੀਅਨ ਗੌਰਮੈਂਟ ਹੈ ਭਾਰਤ ਸਰਕਾਰ ਹੈ ਉਹਦੇ ਦੁਆਰਾ ਪੰਜਾਬ ਪਰ ਫੋਕਸ ਕੀਤਾ ਜਾਂਦਾ ਜੇਕਰ ਨੈਕਸਟ ਟਾਈਮ ਫਿਊਚਰ ਦੇ ਵਿੱਚ ਜੇ ਕਦੇ ਜੰਗ ਲੱਗਦੀ ਹੈ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੀ ਵੀ ਆਪਣੀ ਆਰਮੀ ਦੇ ਫੈਸਲਿਟੀਜ਼ ਨੇ ਉਹਦੇ ਜਿਹੜੇ ਰੋਡ ਰੋਡ ਦੇ ਥਰੂ ਜਿਹੜੀਆਂ ਟੈਂਕਸ ਵਗੈਰਾ ਨੇ ਉਹ ਪਹੁੰਚਣੇ ਹੋਣਗੇ ਆਰਮੀ ਨੇ ਪਹੁੰਚਣਾ ਪੈਰਾਮਿਲਟਰੀ ਫੋਰਸਸਿ ਨੇ ਪਹੁੰਚਣਾ ਉਹਦੇ ਲਈ ਇੱਥੇ ਜਿਹੜਾ ਹੈ ਨੈੱਟਵਰਕ ਡਿਵੈਲਪ ਕਰਨਾ ਟਰਾਂਸਪੋਰਟ ਡਿਵੈਲਪ ਕਰਨਾ ਬੜਾ ਹੀ ਇੰਪੋਰਟੈਂਟ ਆ ਤਾਂ ਉਸ ਪੁਆਇੰਟ ਆੱਫ਼ ਵਿਊ ਤੋਂ ਵੀ ਜਿਹੜੀ ਹੈਗੀ ਆ ਇਹ ਇੱਕ ਬੜੀ ਸਟਰੈਟਜਿਕ ਲੋਕੇਸ਼ਨ ਹੈ ਤਾਂ ਕੱਲ੍ਹ ਨੂੰ ਜੇਕਰ ਵਾਰ ਲੱਗਦੀ ਤਾਂ ਉਸ ਪੁਆਇੰਟ ਆੱਫ ਵੀ ਬੜੀਆਂ ਵੈੱਲ ਡਿਵੈਲਪਡ ਅਤੇ ਵੈੱਲ ਇਸਟੈਬਲਿਸ਼ਡ ਜਿਹੜੀਆਂ ਹੈਗੀਆਂ ਨੇ ਰੋਡਸ ਨੂੰ ਇੱਥੇ ਡਿਵੈਲਪ ਕੀਤਾ ਗਿਆ ਇ ਈਵਨ ਕਿ ਕਈ ਥਾਂ ਦੇ ਉੱਪਰ ਇੱਦਾਂ ਦੇ ਜਿਹੜੇ ਹੈਗੇ ਨੇ ਏਅਰ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਏਅਰਵੇਜ਼ ਵੀ ਜੇ ਡਿਵੈਲਪ ਕੀਤੇ ਆ ਅੰਬਰਸਰ ਦਾ ਏਅਰਪੋਰਟ ਹੋ ਗਿਆ ਹੈਗਾ ਉਹ ਵੀ ਆਵਾਜਾਈ ਦੇ ਵਿੱਚ ਆ ਰਿਹਾ ਹੈਗਾ ਉਹ ਕੁਨੈਕਟ ਹੋਇਆ ਵਾ ਚੰਡੀਗੜ੍ਹ ਹੈ ਠੀਕ ਹੈ ਜਾਂ ਕੁਝ ਡੋਮੈਸਟਿਕ ਏਅਰਪੋਰਟਸ ਨੇ ਬਠਿੰਡੇ ਹੈ ਲੁਧਿਆਣੇ ਹੈ ਇਹ ਡੋਮੈਸਟਿਕ ਏਅਰਪੋਰਟਸ ਜਿਹੜੇ ਕਿ ਅੰਦਰ ਅੰਦਰ ਜਿਹੜੀ ਹੈਗੀ ਆ ਆਪਣੇ ਪੰਜਾਬ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਕਨੈਕਟੀਵਿਟੀ ਕਰਦੇ ਨੇ ਤਾਂ ਇਸ ਤਰੀਕੇ ਨਾਲ਼ ਚਾਹੇ ਉਹ ਆਪਣਾ ਏਅਰ ਆਪਣੀ ਹਵਾਈ ਆਵਾਜਾਈ ਹੋਵੇ ਜਾਂ ਸੜਕੀ ਆਵਾਜਾਈ ਹੋਵੇ ਸਾਰੇ ਪਾਸਿਆਂ ਤੋਂ ਜਿਹੜੇ ਹੈ ਇਹ ਇੱਕ ਵੈੱਲ ਕੁਨੈਕਟਿਡ ਹੈ